ਹੈਲੋ ਹਾਂਜੀ ਹਾਂਜੀ ਦੱਸੋ ਸਤਿ ਸ਼੍ਰੀ ਅਕਾਲ ਦੱਸੋ ਅਸੀਂ ਕੀ ਮਦਦ ਕਰ ਸਕਦੇ ਤੁਹਾਡੀ ਖਾਣ ਵਾਸਤੇ ਸਾਨੂੰ ਸਾਡੇ ਹਰ ਹਰ ਤਰਹਾਂ ਦੀ ਮਿਲ ਜਾਂਦੀ ਆਈਟਮ ਸਾਡੇ ਸਪੈਸ਼ਲ ਥਾਲੀਆਂ ਵੀ ਮਿਲ ਜਾਂਦੀਆਂ ਪੰਜਾਬ ਦੀ ਹਾਂਜੀ ਥਾਲੀ ਵਿੱਚ ਥਾਲੀ ਵਿੱਚ ਪੰਜਾਬ ਦੀ ਸਪੈਸ਼ਲ ਆਈਟਮ ਆ ਜਾਂਦੀ ਹ ਜਿਵੇਂ ਕਿ ਸਰਸੋ ਦਾ ਸਾਗ ਮੱਕੀ ਦੀ ਰੋਟੀ ਨਾਨ ਆ ਜਾਂਦੇ ਆ ਰਾਜਮਾਂਹ ਚਾਵਲ ਪਲਾਓ ਤੇ ਮਿੱਠੇ ਵਿੱਚ ਖੀਰ ਤੇ ਉਹ ਗਾਜਰ ਦਾ ਹਲਵਾ ਆ ਜਾਂਦਾ ਤੇ ਨਾਲ ਲੱਸੀ ਮਿਲ ਜਾਂਦੀ ਹ ਤੇ ਰਾਇਤਾ ਵੀ ਮਿਲ ਜਾਂਦਾ

ਸਾਡੇ ਇਥੇ ਮੈਂਗੋ ਲੱਸੀ ਵੀ ਮਿਲਦੀ ਆ ਸਿੰਪਲ ਲੱਸੀ ਵੀ ਪੀਣਾ ਚਾਹੋ ਤਾਂ ਮਿੱਠੀ ਲੱਸੀ ਵੀ ਪੀਣਾ ਚਾਹੋ ਲੱਸੀ ਮਿਲ ਜਾਂਦੀ ਹ ਫਰੈਸ਼ ਤੁਹਾਨੂੰ ਬਾਕੀ ਤੁਸੀਂ ਜੇ ਸਾਡੇ ਢਾਬੇ ਦੀ ਰੀਵਿਊ ਪੜਨਾ ਚਾਹੁੰਦੇ ਹੋ ਤਾਂ ਸਾਡਾ ਐਪ ਹੈਗਾ ਤੇ ਤੁਸੀਂ ਉੱਥੇ ਜਾ ਕੇ ਦੇਖ ਵੀ ਸਕਦੇ ਹੋ ਡੀਟੇਲਸ ਪੜ ਸਕਦੇ ਹੋ ਹਰ ਆਈਟਮ ਦੀ ਜੋ ਤੁਸੀਂ ਖਾਣਾ ਪਸੰਦ ਕਰੋ ਬਾਕੀ ਸਾਡੇ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਾਡੇ ਫੇਮਸ ਹੈਗੀ ਐ ਨਾਲੇ ਹੁਣ ਸਰਦੀ ਸਰਦੀਆਂ ਦਾ ਟਾਈਮ ਆ ਤੇ ਮਿੱਠੇ ਵਿੱਚ ਹਲਵਾ ਮਿਲ ਜਾਂਦਾ ਖੋਏ ਵਾਲਾ ਮੂੰਗੀ ਦਾ ਹਲਵਾ ਮਿਲ ਜਾਂਦਾ ਨਾਲੇ ਦੇਸੀ ਘਿਓ ਚ ਬਣਿਆ ਹੋਇਆ ਮਿਲਦਾ ਤੁਹਾਨੂੰ ਬਿਲਕੁਲ ਬਿਲਕੁਲ ਪਿਓਰ ਹਾਂਜੀ ਹਾਂਜੀ ਖੀਰ ਵੀ ਮਿਲਦੀ ਆ ਸਾਡੇ ਪਿਓਰ ਦੁੱਧ ਦੀ ਖੀਰ ਮਿਲਦੀ ਆ ਥਾਨੂੰ ਵਿਚ ਡਰਾਈ ਫਰੂਟ ਪਾਏ ਹੁੰਦੇ ਆ ਜੇ ਤੁਸੀਂ ਠੰਡੀ ਵਾਲਾ ਚਾਹੋ ਤਾਂ ਠੰਡੀ ਵੀ ਖਾ ਸਕਦੇ ਓ ਨਹੀਂ ਤਾਂ ਜੇ ਗਰਮ ਵੀ ਖਾਣਾ ਚਾਹੋ ਤਾਂ ਗਰਮ ਵੀ ਦੇ ਦਿੰਨੇ ਆ ਅਸੀਂ ਤੁਸੀਂ ਜਿਵੇ ਜੀ ਖਾਣਾ ਚਾਹੋ ਅਸੀਂ ਤੁਹਾਨੂੰ ਦੇ ਸਕਦੇ ਆ ਬਾਕੀ ਤੁਸੀਂ ਦੇਖਣਾ ਚਾਹੋ ਤਾਂ ਸਾਡੇ ਰੀਵਿਊ ਦੇਖਿਓ ਜਰੂਰ ਤੇ ਆਇਓ ਜਰੂਰ ਤੇ ਨਾਲੇ ਸਾਡੇ ਮੂ ਗਾਜਰ ਦਾ ਹਲਵਾ ਤਾਂ ਜਰੂਰੀ ਈ ਟਰਾਈ ਕਰਿਓ ਤੇ ਲੱਸੀ ਜਰੂਰ ਟਰਾਈ ਕਰਿਓ ਬਿਕੋਜ਼ ਸਾਡੇ ਫੇਮਸ ਹੈ ਢਾਬੇ ਦੀ ਚੀਜ਼ਾਂ ਇਸ ਲਈ ਜਰੂਰ ਟਰਾਈ ਕਰੀਓ ਓਕੇ ਜਰੂਰ ਆਇਓ